ਅਗਲੇ ਕੁਝ ਸਾਲਾਂ ਵਿੱਚ ਜੀਵਨ ਦਾ ਆਈ ਥਿੰਕ ਸੋ ਏ ਆਈ ਜਿਹੜਾ ਹੈ ਕਾਫੀ ਜ਼ਿਆਦਾ ਪ੍ਰਭਾਵ ਦਾ ਹੈਗਾ ਔਰ ਡੀ ਪਲਾਨਿੰਗ ਜਿਹੜੀ ਹੈ ਉਹ ਕਾਫੀ ਫਾਇਦੇਮੰਦ ਰਹੇਗੀ ਕਿਉਂਕਿ ਕਾਫੀ ਸਾਰੇ ਫੀਲਡਸ ਨੇ ਜਿੱਦਾਂ ਕਿ ਅਗਰ ਅਸੀਂ ਆਰਟਸ ਦੇ ਵਿੱਚ ਕਰਨ ਕੁਝ ਕਰਨਾ ਹੋਵੇ ਜਾਂ ਮਿਊਜਿਕ ਦੇ ਵਿੱਚ ਕੁਝ ਕਰਨਾ ਹੋਵੇ ਤਾਂ ਉਹਨਾਂ ਫੀਲਡਸ ਦੇ ਵਿੱਚ ਇਹ ਕਾਫੀ ਜ਼ਿਆਦਾ ਇਫੈਕਟਿਵ ਹੈ ਬਾਕੀ ਰੋਬੋਟਸ ਤਾਂ ਸਾਡੀ ਹੈਲਪ ਕਰ ਹੀ ਰਹੇ ਨੇ ਕਾਫੀ ਹੱਦ ਤੱਕ ਔਰ ਜੇ ਅਗਲੀ ਜਨਰੇਸ਼ਨ ਦੇ ਵਿੱਚ ਰੋਬਟਸ ਜਿਹੜੇ ਆ ਉਹ ਨੋਰਮਲ ਫੈਮਿਲੀਜ਼ ਨੂੰ ਵੀ ਮਿਡਲ ਕਲਾਸ ਨੂੰ ਮਿਲਣੇ ਸ਼ੁਰੂ ਹੋ ਗਏ ਮਾਰਕੀਟ ਦੇ ਵਿੱਚ ਤਾਂ ਉਹਨਾਂ ਦਾ ਕੰਮ ਈਜ਼ੀ ਹੋ ਜਾਵੇਗਾ ਸਾਰੇ ਘਰ ਦੇ ਕੰਮ ਜਿਹੜੇ ਹੈ ਜੇ ਘਰ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਘਰ ਦੇ ਕੰਮ ਜਿਹੜੇ ਨੇ ਉਹ ਸਾਰੇ ਰੋਬਟਸ ਤੋਂ ਹੀ ਕਰਵਾ ਲਿਆ ਕਰਨੇ ਹੈ ਜਿੰਨੇ ਹਾਊਸਹੋਲਡ ਕੋਰਸ ਨੇ ਬਾਕੀ ਰੋਟੀ ਪਾਣੀ ਦੇ ਵਿੱਚ ਵੀ ਉਹਦੀ ਹੈਲਪ ਮਿਲ ਜਾਇਆ ਕਰੇਗੀ ਸੁਜੈਸ਼ਨ ਤੁਹਾਨੂੰ ਕਾਫੀ ਅੱਛੇ ਮਿਲ ਜਾਣਗੇ ਔਰ ਹਾਂ ਅਗਰ ਗੱਲ ਕੀਤੀ ਜਾਵੇ ਕਿ ਜਿੱਦਾ ਡਾਈਟਸ ਜਿਹੜੀਆਂ ਨੇ ਉਹਦੇ ਵਿੱਚ ਹੈਲਪ ਮਿਲ ਜਾਵੇਗੀ ਨਿਊ ਐਨਰਜੀ ਸਲਿਊਸ਼ਨ ਜਿਹੜੇ ਆ ਰਹੇ ਨੇ ਉਹਦੇ ਕਰਕੇ ਕਿ ਐਨਰਜੈਟਿਕ ਡਾਈਟਸ ਕਿਹੜੀਆਂ ਨੇ ਤਾਂ ਪ੍ਰੋਬਲਮ ਇੰਨੀਆਂ ਡਾਇਟ ਦੇ ਕਰਕੇ ਮਤਲਬ ਖਰਾਬ ਖਾਣਾ ਕਰਕੇ ਹੋ ਰਹੀਆਂ ਨੇ ਉਹ ਸਾਰੀਆਂ ਜਿਹੜੀਆਂ ਨੇ ਉਹ ਸੋਰਟ ਆਊਟ ਹੋ ਜਾਣਗੀਆਂ ਮੁੱਕਦੀ ਗੱਲ ਤਾਂ ਇਹੀ ਹੈ ਕਿ ਅਗਲਾ ਜਿਹੜਾ ਫਿਊਚਰ ਜਨਰੇਸ਼ਨਸ ਹੈਗੀਆਂ ਨੇ ਫਿਊਚਰ ਜਿਹੜਾ ਹੈਗਾ ਉਹਦੇ 'ਚ ਟੈਕਨੋਲੋਜੀ ਕਾਫੀ ਹਾਈਲੀ ਇਫੈਕਟਿਵ ਹੋਣ ਵਾਲੀ ਆ ਔਰ ਹੁਣ ਵੀ ਅਸੀਂ ਤਕਰੀਬਨ ਸਾਰਾ ਦਿਨ ਫੋਨ ਦੇ ਵਿੱਚ ਘਿਰੇ ਰਹਿੰਦੇ ਹਾਂ ਤਾਂ ਅਗਲਾ ਜਿਹੜਾ ਸਮੇਂ ਆ ਰਿਹਾ ਉਹ ਤਾਂ ਕੰਪਲੀਟਲੀ ਟੈਕਨੋਲੋਜੀ ਸਾਨੂੰ ਟੇਕਓਵਰ ਕਰਨ ਵਾਲੀ ਆ